ਸਤਿ ਸ਼੍ਰੀ ਕਾਲ ਭਾਅ ਜੀ ਮੈਂ ਪ੍ਰਿੰਸੀ ਗੱਲ ਕਰ ਰਹੀ ਹਾਂ ਜਿਵੇਂ ਕਿ ਮੈਂ ਤੁਹਾਡੇ ਇੰਸਟਾਗ੍ਰਾਮ ਪੇਜ਼ ਲੱਕੀ ਮੋਬਾਈਲ ਸ਼ੋਪ ਤੋਂ ਇੱਕ ਮੋਬਾਇਲ ਔਡਰ ਕੀਤਾ ਸੀ ਮੈਨੂੰ ਸਭ ਤੋਂ ਵਧੀਆ ਗੱਲ ਇਹ ਲੱਗੀ ਕਿ ਜਿੱਥੇ ਮੋਬਾਈਲ ਵੀਹ ਦਿਨਾਂ ਬਾਅਦ ਡਿਲਵਰ ਹੋਣਾ ਸੀ ਅਤੇ ਉਹ ਮੈਨੂੰ ਦਸ ਦਿਨ ਪਹਿਲਾਂ ਹੀ ਆ ਚੁੱਕਾ ਹੈ ਮੈਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋਈ ਅਤੇ ਮੋਬਾਈਲ ਬਹੁਤ ਹੀ ਵਧੀਆ ਹੈ ਉਸਦੇ ਫੀਚਰ ਐਪਸ ਬਹੁਤ ਹੀ ਜ਼ਿਆਦਾ ਵਧੀਆ ਹੈ ਸਭ ਤੋਂ ਜ਼ਿਆਦਾ ਖੁਸ਼ੀ ਮੋਬਾਈਲ ਨਾਲ ਮੋਬਾਈਲ ਕਵ ਕਵਰ ਅਤੇ ਗਲਾਸ ਵੀ ਮੈਨੂੰ ਫਰੀ ਮਿਲਿਆ ਹੈ ਅਤੇ ਮੈਨੂੰ ਇਹ ਦੇਖ ਕੇ ਬਹੁਤ ਹੀ ਵਧੀਆ ਲੱਗੀ ਮੇਰੇ ਸਾਰੇ ਫਰੈਂਡਸ ਇਹ ਜਾਣ ਕੇ ਬਹੁਤ ਹੀ ਹੈਰਾਨ ਹੈ ਕਿ ਤੈਨੂੰ ਇੰਨਾ ਵਧੀਆ ਮੋਬਾਈਲ ਔਨਲਾਈਨ ਸ਼ੋਪ ਤੋਂ ਔਡਰ ਕਰਨ 'ਤੇ ਮਿਲਿਆ ਹੈ ਅਤੇ ਉਹ ਮੋਬਾਈਲ ਨੂੰ ਦੇਖ ਕੇ ਬਹੁਤ ਖੁਸ਼ ਹੋਈਆਂ ਮੋਬਾਈਲ ਦਾ ਹਰ ਇੱਕ ਫੀਚਰ ਸੈਟਿੰਗ ਬਹੁਤ ਹੀ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਅਤੇ ਮੋਬਾਈਲ ਦੇ ਕੈਮਰੇ ਦੀ ਕਲੈਰੀਟੀ ਬਹੁਤ ਹੀ ਜ਼ਿਆਦਾ ਵਧੀਆ ਹੈ ਮੇਰਾ ਫੋਨ ਬਿਲਕੁਲ ਇੱਕ ਵਧੀਆ ਅਤੇ ਹਾਈ ਕਲਾਸ ਫੋਨ ਨਾਲੋਂ ਬਿਲਕੁਲ ਘੱਟ ਨਹੀਂ ਹੈ ਮੇਰਾ ਫੋਨ ਬਹੁਤ ਹੀ ਵਧੀਆ ਚੱਲ ਰਿਹਾ ਅਤੇ ਉਹਦੇ ਨਾਲ ਮੈਨੂੰ ਫਰੀ ਚਾਰਜਰ ਹੈੱਡਫੋਨਸ ਬਹੁਤ ਹੀ ਵਧੀਆ ਮਿਲੇ ਹਨ ਫੋਨ ਇੱਕਦਮ ਵਧੀਆ ਕੁਐਲਟੀ ਦਾ ਹੁੰਦਾ ਹੈ ਅਤੇ ਮੈਨੂੰ ਤੁਹਾਡੇ ਤੋਂ ਫੋਨ ਔਡਰ ਕਰਕੇ ਬਹੁਤ ਹੀ ਅੱਛਾ ਲੱਗਾ ਅਤੇ ਬਹੁਤ ਹੀ ਖੁਸ਼ੀ ਹੋਈ